ਹੈਲੋ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਹਾਂਜੀ ਤੁਹਾਡੇ ਬੱਚੇ ਦੇ ਨੰਬਰ ਤਾਂ ਵਧੀਆ ਆਏ ਆ ਅਤੇ ਪਰ ਉਹ ਇੱਕ ਅੱਧੇ ਵਿਸ਼ੇ ਚੋਂ ਜਿਹੜਾ ਵਾ ਉਹ ਵੀਕ ਆ ਅਤੇ ਵੈਸੇ ਤਾਂ ਇਹਦੇ ਚਾਰ ਸੌ ਤੋਂ ਸਾਢੇ ਤਿੰਨ ਸੌ ਨੰਬਰ ਆ ਅਤੇ ਉਹ ਜਿਹੜਾ ਥੋੜ੍ਹਾ ਬਹੁਤਾ ਜਿਹੜੇ ਵਿਸ਼ੇ 'ਚ ਵੀਕ ਆ ਉਹ ਤੁਸੀਂ ਇਹਨੂੰ ਹੋਰ ਮਿਹਨਤ ਕਰਵਾਓ ਜਾਂ ਤਾਂ ਇਹਦੀ ਟਿਵੀਸ਼ਨ ਰਖਾਓ ਅਤੇ ਜਾਂ ਤੁਸੀਂ ਇਹਨੂੰ ਘਰ ਮਿਹਨਤ ਕਰਾਇਆ ਕਰੋ

ਠੀਕ ਹੈ ਤੁਸੀਂ ਜਦੋਂ ਜਾਂਦੇ ਜੀ ਉਹਨਾਂ ਨੂੰ ਆਪ ਕਿਹਾ ਕਰੋ ਆਪ ਵੇਖ ਕੇ ਆਇਆ ਕਰੋ ਕਿ ਕਿੰਨਾ ਕਿਹੜਾ ਕੰਮ ਮਿਲਿਆ ਵਾ ਕਿਹੜਾ ਕੰਮ ਉਹਨਾਂ ਨੇ ਕਰਵਾਇਆ ਵਾ ਤਾਂ ਆ ਕੇ ਤੁਸੀਂ ਘਰ ਆ ਕੇ ਵੀ ਪੜ੍ਹਾਇਆ ਕਰੋ ਇਹਨੂੰ ਠੀਕ ਹੈ ਠੀਕ ਹੈ ਅਤੇ ਇਹ ਥੋੜ੍ਹੀਆਂ ਜਿਹੀਆਂ ਕਲਾਸ 'ਚ ਸ਼ਰਾਰਤਾਂ ਵੀ ਕਰਦਾ ਵਾ ਸ਼ੈਤਾਨ ਹੈ ਅਤੇ ਇਹਨੂੰ ਇਹਦੇ ਤੋਂ ਵੀ ਸਮਝਾਓ ਥੋੜ੍ਹਾ ਜਿਹਾ ਅਸੀਂ ਤਾਂ ਆਪਣਾ ਜ਼ੋਰ ਲਾਉਣ ਹੀ ਡੇ ਤੁਸੀਂ ਵੀ ਕਹੋ ਥੋੜ੍ਹਾ ਜਿਹਾ ਹਾਂਜੀ ਹਾਂਜੀ ਠੀਕ ਹੈ ਕੋਈ ਨਹੀਂ ਇਹ ਹੋ ਜੂਗਾ ਸੈਟ ਪੜ੍ਹਾਈ 'ਚ ਵੀ ਹੋ ਜੂਗਾ ਸਹੀ ਬਸ ਥੋੜ੍ਹੀ ਜਿਹੀ ਇਹਨੂੰ ਮਿਹਨਤ ਦੀ ਲੋੜ ਆ ਮੈਂ ਤੁਹਾਨੂੰ ਇਹਦਾ ਰਿਜ਼ਲਟ ਬਣਾ ਦਿੰਦੀ ਅਤੇ ਇੱਥੇ ਆਪਣੇ ਸਾਈਨ ਕਰ ਦਿਓ ਹਾਂਜੀ ਠੀਕ ਹੈ ਓਕੇ